ਹਾਂਜੀ ਜਦੋਂ ਆਪਾਂ ਕਈ ਵਾਰ ਦੇਖਦੇ ਹਾਂ ਵੀ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਨਾ ਲੋਕਾਂ ਨੂੰ ਕਲਾ ਅਤੇ ਸ਼ਿਲਪਕਾਰੀ ਵਿੱਚ ਕਿਵੇਂ ਮਦਦ ਕੀਤੀ ਹੈ ਜਦੋਂ ਇਹ ਆਪਾਂ ਜੇ ਆਪਾਂ ਇਹਦੀ ਇਸ ਤਰ੍ਹਾਂ ਗੱਲ ਕਰਦੇ ਹਾਂ ਨਾ ਜਿਹੜਾ ਸੋਸ਼ਲ ਮੀਡੀਆ ਅਤੇ ਸ਼ਿਲਪਕਾਰੀ ਨੇ ਨਾ ਦੁਨੀਆਂ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖਤਾ ਇਹਦੇ ਵਿੱਚ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਸ ਨੇ ਲੋਕਾਂ ਨੂੰ ਕਲਾ ਅਤੇ ਸ਼ਿਲਪਕਾਰੀ ਵਿੱਚ ਸ਼ਾਮਲ ਹੋਣ ਲਈ ਬਹੁਤ ਸਾਰੇ ਰਸਤੇ ਖੋਲ੍ਹ ਦਿੱਤੇ ਹਨ ਇਹਦੇ ਨਾਲ ਕੀ ਹੈ ਇਹੋ ਜਿਹੇ ਚੈਨਲਾਂ ਦੇ ਨਾਲ ਕਿਸ ਸੌਖ ਖਣ ਦਾ ਜਿਹੜਾ ਸੌਖਾ ਤਰੀਕਾ ਹੋ ਜਾਂਦਾ ਹੈਗਾ ਅਤੇ ਬੱਚਾ ਹੈਗਾ ਜਿਹੜਾ ਕੋਈ ਵੀ ਆਪਾਂ ਇਨਸਾਨ ਹੈ ਇਹਨੂੰ ਚੰਗੀ ਤਰ੍ਹਾਂ ਨਾਲ ਆਪਾਂ ਸਿੱਖ ਸਕਦੇ ਹੈਗੇ ਇਹਦੀਆਂ ਕਲਾਸਾਂ ਲੱਗਦੀਆਂ ਨੇ ਬਹੁਤ ਜ਼ਿਆਦਾ ਆਪਣੇ ਯੂਟਿਊਬ ਦੇ ਉੱਪਰ ਬ ਇੰਸਟਾਗਰਾਮ ਦੇ ਉੱਪਰ ਅਤੇ ਹੋਰ ਫੇਸਬੁੱਕ ਦੇ ਉੱਪਰ ਵੀ ਹਜ਼ਾਰਾਂ ਹੀ ਜਿਹੜੇ ਆਪਾਂ ਨੂੰ ਇਹ ਗਾਈਡ ਕਰਦੇ ਨੇ ਵੀ ਕਿਸ ਤਰ੍ਹਾਂ ਆਪਾਂ ਇਹ ਚੀਜ਼ਾਂ ਬਣਾਉਣੀਆਂ ਨੇ ਤਾਂ ਉਹ ਬਹੁਤ ਵਧੀਆ ਆਪਾਂ ਸਿੱਖ ਸਕਦੇ ਹਾਂ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਕਿਸੇ ਕੋਈ ਵੱਖਰਾ ਜਾਂ ਟਿਊਸ਼ਨ ਜਾਂ ਕੋਚਿੰਗ ਸੈਂਟਰ ਜਾਣ ਦੀ ਲੋੜ ਨਹੀਂ ਪੈਂਦੀ ਆਪਾਂ ਇਸ ਤਰ੍ਹਾਂ ਵੀ ਆਪਾਂ ਨੂੰ ਪਤਾ ਹੀ ਹੈਗਾ ਵੀ ਜਿਹੜੇ ਕੋਈ ਗਾਈਡਾਂ ਜਾਂ ਕੁਛ ਹੋਰ ਇਹ ਸਾਰਾ ਕੁਛ ਕੀ ਆ ਆਨਲਾਈਨ ਉਪਲੱਬਧ ਹੋ ਜਾਂਦਾ ਆਪਾਂ ਘਰ ਬੈਠੇ ਹੀ ਯੂਟੀਊਬ 'ਚੋਂ ਕਿੰਨੀਆਂ ਚੀਜ਼ਾਂ ਭੰਗੜਾ ਹੋ ਗਿਆ ਕ ਕੁਛ ਮਰਜ਼ੀ ਸਿੱਖ ਸਕਦੇ ਹੈਗੇ ਕੋਈ ਚੀਜ਼ ਬਣਾਉਣੀ ਆ ਜੋ ਵੀ ਕੁਛ ਕਰਨਾ ਬਹੁਤ ਵਧੀਆ ਢੰਗ ਦੇ ਨਾਲ ਆਪਾਂ ਸਿੱਖ ਸਕਦੇ ਹਾਂ ਜੇ ਦੂਜੀ ਗੱਲ ਆਪਾਂ ਇਹ ਵੀ ਨਾਲ ਨਾਲ ਦੇਖਦੇ ਹਾਂ ਜਦੋਂ ਸੋਸ਼ਲ ਮੀਡੀਆ ਨੇ ਕਲਾਕਾਰਾਂ ਨੂੰ ਜਿਹੜਾ ਇੱਕ ਦੂਜੇ ਨਾਲ ਜੁੜਨਾ ਅਤੇ ਆਪਣੇ ਕੰਮ ਆ ਜਿਹੜੇ ਸਾਂਝੇ ਕਰਨ ਦਾ ਵੀ ਮੌਕਾ ਦਿੱਤਾ ਦੇਖੋ ਜੇ ਕੋਈ ਕ ਅ ਵਿਅਕਤੀ ਕਿਸੇ ਕੰਮ ਦੇ ਵਿੱਚ ਪਰਫੈਕਟ ਹੈ ਤਾਂ ਉਹ ਆਪਣਾ ਹੁਨਰ ਦੂਜਿਆਂ ਦੇ ਨਾਲ ਸਾਂਝਾ ਕਰਨ ਦਾ ਜਿਹੜਾ ਇੱਕ ਵਧੀਆ ਸਾਧਨ ਹੈਗਾ ਜਿਹੜਾ ਆਪਣਾ ਯੂਟੀਊਬ ਵਗੈਰਾ ਹੈਗਾ ਸੋਸ਼ਲ ਮੀਡੀਆ 'ਤੇ ਆਪਾਂ ਦੇਖੋ ਜਿਵੇਂ ਅੱਜ ਕੱਲ੍ਹ ਉਹ ਹੈਗੀ ਕਿਰਨਾ ਬਠਿੰਡਾ ਕਿੰਨੀਆਂ ਘੈਂਟ ਘੈਂਟ ਵੀਡੀਓ ਬਣਾਉਂਦੀ ਆ ਜਾਂ ਬਰਨਾਲਾ ਦੇ ਉਹ ਸੁਖ ਜੋਹਲ ਹੈਗਾ ਉਹ ਜੇਕਰ ਜਿਵੇਂ ਅਸੀਂ ਇੱਕ ਫਿਟਨੈਸ ਉਹ ਕਿਵੇਂ ਕਰਦਾ ਤਾਂ ਪਿੰਕਾ ਜਰਗ ਦੀਆਂ ਕਿੰਨੀਆਂ ਜ਼ਿਆਦਾ ਉਹ ਆ ਰਿਹਾ ਹੈਗਾ ਉਹ ਸਾਰੇ ਉਹਤੋਂ ਸਿੱਖ ਰਹੇ ਨੇ ਤਾਂ ਇਹਦੇ ਵਿੱਚ ਕੀ ਹੈ ਅਤੇ ਮੈਂ ਵੀ ਜਿਹੜਾ ਹੈਗਾ ਇੱਕ ਯੂਟੀਊਬ ਚੈਨਲ ਤੋਂ ਦੇਖ ਕੇ ਨਾ ਯੂਟੀਊਬ ਚੈਨਲ ਦਾ ਮੇਰੇ ਦਾ ਨਾਮ ਹੈਗਾ ਆਰਟ ਅ ਵਿਦ ਫਲੋਅ ਇੱਥੋਂ ਮੈਂ ਦੇਖ ਕੇ ਡਰਾਇੰਗ ਪੇਟਿੰਗ ਅਤੇ ਹੋਰ ਵੀ ਕਈ ਸਾਰੇ ਆਰਟ ਇੱਥੋਂ ਮੈਂ ਸਿੱਖੀ ਹੈ ਅਤੇ ਮੈਂ ਦੂਜਿਆਂ ਨੂੰ ਵੀ ਸਲਾਹ ਦੇਵਾਂਗਾ ਕਈ ਵਾਰ ਆਪਣੇ ਕੋਲ ਟਾਈਮ ਨਹੀਂ ਹੁੰਦਾ ਗਾ ਵੀ ਬਾਹਰ ਐਕਸਟਰਾ ਕੋਚਿੰਗ ਲੈ ਆਉਂਦਾ ਤਾਂ ਯੂਟੀਊਬ ਹੈ ਨਾ ਜਿਹੜੇ ਇੱਕ ਬਹੁਤ ਵਧੀਆ ਸਾਧਨ ਹੈਗਾ ਕੋਈ ਵੀ ਚੀਜ਼ ਅਸੀਂ ਅਸਾਨੀ ਦੇ ਨਾਲ ਸਿੱਖ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਜੀ